ਹੈਲੋ ਹੈਲੋ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਤੁਸੀਂ ਮੋਨਿਕਾ ਬੋਲ ਰਹੇ ਜੀ ਹਾਂਜੀ ਮੈਨੂੰ ਇੱਕ ਨਾ ਤੁਹਾਡੇ ਦੋਸਤ ਅਮਨ ਏ ਆ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਅਤੇ ਮੈਂ ਪੁੱਛਣਾ ਸੀਗਾ ਮੈਂ ਇਧਰ ਤੁਹਾਡੇ ਇਧਰ ਨਵਾਂ ਸ਼ਹਿਰ ਆਉਣਾ ਸੀਗਾ ਮੈਂ ਦਿੱਲੀ ਤੋਂ ਬਿਲੋਂਗ ਕਰਦਾ ਏ ਹਾਂ ਤਾਂ ਮੈਂ ਕੋਈ ਇਥੇ ਹੋਸ ਹੋਟਲ ਵਗੈਰਾ 'ਚ ਰਹਿਣਾ ਹੈ ਕਿਸੇ 'ਚ ਅਤੇ ਮੈਨੂੰ ਕੋਈ ਵਧੀਆ ਜਿਹਾ ਹੋਟਲ ਦੇ ਕੋਈ ਨਾਮ ਵਗੈਰਾ ਦੱਸੋ ਜਿਹਨਾਂ 'ਚ ਮੈਂ ਕੁਝ ਰਹਿ ਸਕਾਂ ਉਥੇ ਪਾਰਕਿੰਗ ਦੀ ਸੁਵਿਧਾ ਵਗੈਰਾ ਹੋਵੇ ਅਤੇ ਖਾਣਾ ਵਧੀਆ ਵਗੈਰਾ ਹੋਵੇ ਅਤੇ ਉਹਦਾ ਮੈਨੂੰ ਨਾਲ ਦੱਸਣਾ ਵੀ ਹੈ ਕਿਸੇ ਦਾ ਕਿ ਜਿਹੜਾ ਕੋਈ ਸਪੈਸ਼ਲ ਕੋਈ ਖਾਣਾ ਹੈਗਾ ਤਾਂ ਉਹਦੇ ਬਾਰੇ ਜ਼ਰੂਰ ਦੱਸਣਾ ਮੈਨੂੰ ਦੱਸਿਓ ਕੋਈ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਰੋਡ ਵਗੈਰਾ ਖਾ ਖੁੱਲਾ ਖੁੱਲਾ ਹੈਗਾ ਹਾਂ ਉਹ ਇਦਾਂ ਨਾ ਹੋਵੇ ਹਾਂ ਇਦਾਂ ਨਾ ਹੋਵੇ ਕੋਈ ਸ਼ਹਿਰ 'ਚ ਵੀ ਨਹੀਂ ਚਾਹੀਦਾ ਮੈਨੂੰ ਮੈਨੂੰ ਸ਼ਹਿਰ 'ਚ ਨਹੀਂ ਚਾਹੀਦਾ ਹੈਗਾ ਸ਼ਹਿਰ ਦੇ ਵਿੱਚ ਕਾਫੀ ਗੱਡੀਆਂ ਫਸ ਜਾਂਦੀਆਂ ਇਸ ਕਰਕੇ ਮੈਂ ਬਾਹਰ ਕੋਈ ਦੇਖਣਾ ਚਾਹੁੰਦਾ ਹਾਂ ਅੱਛਾ ਜੀ ਅੱਛਾ ਅੱਛਾ ਅੱਛ ਠੀਕ ਏ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇਲ ਦੇਣ ਲਈ ਠੀਕ ਠੀਕ ਹੈ ਓ ਓਕੇ ਥੈਂਕ ਯੂ